ਹਾਂਜੀ ਪਿਛਲੇ ਹੀ ਦਿਨੀਂ ਮੈਂ ਦੁਬਈ ਜਾਣਾ ਸੀ ਅਤੇ ਮੈਂ ਏਅਰਪੋਰਟ ਜਾਣ ਲਈ ਕੈਬ ਬੁੱਕ ਕਰੀ ਸੀ ਅਤੇ ਮੈਂ ਉੱਥੇ ਜਾਣ ਲਈ ਡਰਾਇਵਰ ਨੂੰ ਕੋਲ ਕੀਤੀ ਅਤੇ ਮੈਂ ਇਹ ਕੈਬ ਚਾਰ ਹੀ ਦਿਨ ਪਹਿਲਾਂ ਬੁੱਕ ਕਰ ਲਈ ਸੀ ਇਹ ਮੇਰਾ ਕੋਈ ਨਿੱਜੀ ਕੰਮ ਸੀ ਜੋ ਕਿ ਜਿਸ ਲਈ ਮੈਂ ਇੱਕ ਮਹੀਨੇ ਲਈ ਜਾਣਾ ਸੀ ਅਤੇ ਮੈਂ ਏਅਰਪੋਰਟ ਲਈ ਲਗਭਗ ਛੇ ਜਾਂ ਸੱਤ ਘੰਟੇ ਪਹਿਲਾਂ ਹੀ ਜਾਣਾ ਸੀ ਅਤੇ ਮੈਂ ਸੋਚਿਆ ਕਿਉਂ ਨਾ ਕੈਬ ਹੀ ਕਰ ਲਈ ਜਾਵੇ ਸੋ ਮੈਂ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਚਾਰ ਦਿਨ ਪਹਿਲਾਂ ਹੀ ਡਰਾਇਵਰ ਨਾਲ਼ ਗੱਲ ਕਰ ਲਈ ਸੀ ਅਤੇ ਮੈਂ ਉਸਨੂੰ ਇਸ ਗੱਲ ਬਾਰੇ ਚੰਗੀ ਤਰ੍ਹਾਂ ਦੱਸ ਦਿੱਤਾ ਸੀ ਕਿ ਮੇਰਾ ਇਹ ਕੰਮ ਬਹੁਤ ਜ਼ਰੂਰੀ ਹੈ ਅਤੇ ਮੇਰਾ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ ਅਤੇ ਮੈਂ ਉਸਨੂੰ ਪਹਿਲਾਂ ਹੀ ਪੁੱਛ ਲਿਆ ਸੀ ਕਿ ਵੀ ਉਹ ਕਦੋਂ ਪਹੁੰਚੇਗਾ ਅਤੇ ਉਸਨੂੰ ਮ ਉਸਨੇ ਮੈਨੂੰ ਇਹ ਯਕੀਨੀ ਬਣਾ ਦਿੱਤਾ ਸੀ ਕਿ ਉਹ ਪੂਰੇ ਸਮੇਂ ਉੱਤੇ ਸ਼ਾਮ ਨੂੰ ਛੇ ਵਜੇ ਤੱਕ ਪਹੁੰਚ ਜਾਵੇਗਾ